ਸਤਿ ਸ਼੍ਰੀ ਅਕਾਲ ਕੀ ਤੁਸੀਂ ਉਬਰ ਸਰਵਿਸ ਸੈਂਟਰ ਤੋਂ ਬੋਲ ਰਹੇ ਹੋ ਮੇਰਾ ਨਾਮ ਸੁਨੇਹਾ ਕੁਮਾਰੀ ਹੈ ਕੱਲ੍ਹ ਰਾਤ ਮੈਂ ਆਪਣੇ ਕੁਛ ਦੋਸਤਾਂ ਦੇ ਨਾਲ ਚੰਡੀਗੜ੍ਹ ਘੁੰਮਣ ਗਈ ਸੀ ਉਥੋਂ ਮੇਰੀ ਰਾਤ ਦੀ ਟ੍ਰੇਨ ਸੀ ਅਤੇ ਮੈਂ ਰਾਤੀ ਅੰਮ੍ਰਿਤਸਰ ਪਹੁੰਚੀ ਰਾਤੀ ਜਦੋਂ ਮੈਂ ਅੰਮ੍ਰਿਤਸਰ ਪਹੁੰਚੀ ਤਾਂ ਉਸ ਤੋਂ ਬਾਅਦ ਮੈਨੂੰ ਤਰਨ ਤਾਰਨ ਆਉਣ ਵਾਸਤੇ ਕੋਈ ਕਨਵੀਨੀਅਸ ਨਹੀਂ ਸੀ ਤਾਂ ਮੈਂ ਰਾਤੀ ਮੈਂ ਆਪਣੇ ਘਰਦਿਆਂ ਨੂੰ ਫੋਨ ਕੀਤਾ ਅਤੇ ਉਹ ਵੀ ਮੈਨੂੰ ਲੈਣ ਨਹੀਂ ਆ ਸਕਦੇ ਸੀ ਕੁਛ ਵਜ੍ਹਾ ਦੇ ਨਾਲ ਕਿਉਂਕਿ ਜਿੰਨਾਂ ਟਾਈਮ ਉਹਨਾਂ ਨੇ ਮੈਨੂੰ ਲੈਣ ਆਉਣਾ ਸੀ ਉਨਾਂ ਟਾਈਮ ਨੂੰ ਉਦਾਂ ਵੀ ਬਹੁਤ ਦੇਰ ਹੋ ਜਾਣੀ ਸੀ ਅਤੇ ਰਾਤੀ ਧੁੰਦਾਂ ਦੇ ਕਾਰਨ ਕੋਈ ਆ ਵੀ ਨੀ ਸਕਦਾ ਸੀ ਇਸ ਕਰਕੇ ਰਾਤੀ ਮੈਂ ਉਬਰ ਤੋਂ ਆਪਣੀ ਕੈਬ ਬੁੱਕ ਕੀਤੀ ਅਤੇ ਅਪ ਉਬਰ ਦੇ ਇੱਕ ਐਪ ਤੋਂ ਉਬਰ ਵਾਲਿਆਂ ਨੇ ਇੱਕ ਡਰਾਈਵਰ ਨੂੰ ਭੇਜਿਆ ਅਤੇ ਉਹਨਾਂ ਨੇ ਮੈਨੂੰ ਬਹੁਤ ਸੇਫਲੀ ਮੇਰੇ ਘਰ ਪਹੁੰਚਾਇਆ ਮੈਂ ਇਹ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹਾਂ ਕਿ ਤੁਹਾਡੀ ਉਬਰ ਸਰਵਿਸ ਇੰਨੀ ਜ਼ਿਆਦਾ ਵਧੀਆ ਹੈ ਕਿ ਉਹਨਾਂ ਦੇ ਡਰਾਈਵਰ ਇੰਨੇ ਜ਼ਿਆਦਾ ਐਕਸਪੀਰੀਅੰਸਡ ਨੇ ਕਿ ਉਹਨਾਂ ਨੇ ਮੈਨੂੰ ਇੰਨੀ ਰਾਤੀ ਉਹ ਵੀ ਇੰਨੀ ਧੁੰਦ ਵਿੱਚ ਸੇਫਲੀ ਮੈਨੂੰ ਪਹੁੰਚਾਇਆ ਆਪਣੇ ਘਰ ਮੇਰੇ ਘਰਦਿਆਂ ਨੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਕੀਤਾ ਅਤੇ ਮੈਂ ਇਹ ਤੁਹਾਨੂੰ ਕਹਿਣਾ ਚਾਹੂੰਗੀ ਕਿ ਤੁਹਾਡੀ ਉਬਰ ਸਰਵਿਸ ਅੱਗੇ ਵੀ ਇੱਦਾਂ ਹੀ ਸਾਰਿਆਂ ਨੂੰ ਆਪਣੀ ਸਰਵਿਸ ਦਿੰਦੀ ਰਹੇ ਅਤੇ ਮੈਂ ਇਸਨੂੰ ਪੂਰੇ ਦੇ ਪੂਰੇ ਪੰਜ ਸਟਾਰ ਦੇਣਾ ਚਾਹੂੰਗੀ ਥੈਂਕ ਯੂ ਸੋ ਮਚ